ਨਹੀਂ ਜੋ ਕਿ ਮੀਡੀਆ ਹੈ ਨਾ ਉਹ ਸਾਰੀਆਂ ਚੀਜ਼ਾਂ ਕਵਰ ਨਹੀਂ ਕਰਦਾ ਹੈਗਾ ਇਹ ਮੋਸਟਲੀ ਜੋ ਕਿ ਸੈਲੀਬ੍ਰਿਟੀਜ਼ ਹੈ ਜਾਂ ਵੱਡੇ ਵੱਡੇ ਸਟਾਰ ਹੈ ਚਾਹੇ ਬੋਲੀਵੁੱਡ ਟੋਲੀਵੁੱਡ ਉਹਨਾਂ ਦੀਆਂ ਖਬਰਾਂ ਜ਼ਿਆਦਾ ਛਪਾਉਂਦੇ ਆ ਜਾਂ ਜ਼ਿਆਦਾ ਦਿਖਾਉਂਦੇ ਨੇ ਜੋ ਕਿ ਗਲਤ ਗੱਲ ਹੈ ਆਮ ਲੋਕਾਂ ਦੀ ਜਾਂ ਲੋਕਾਂ ਨੂੰ ਕਿਹੜੀਆਂ ਗੱਲਾਂ ਸਫਰ ਕਰਨੀਆਂ ਪੈ ਰਹੀਆਂ ਫੇਸ ਕਰਨੀਆਂ ਪੈ ਰਹੀਆਂ ਸਾਹਮਣਾ ਕਰਨਾ ਪੈ ਰਿਹਾ ਉਹ ਇਹ ਚੀਜ਼ ਤੱਕ ਕਦੇ ਨਹੀਂ ਦਿਖਾਉਂਦੇ ਜੋ ਕਿ ਬਹੁਤ ਗਲਤ ਗੱਲ ਆ ਜਦ ਦੇਖੋ ਤੁਸੀਂ ਖਬਰਾਂ ਦੇਖੋ ਤਾਂ ਕਿਸੇ ਸਟਾਰ ਦਾ ਬੱਚਾ ਕੁਛ ਕਰ ਰਿਹਾ ਹੈ ਨਾ ਉਹਦੀ ਦਿਖਾ ਦੇਣਗੇ ਜਾਂ ਸਟਾਰ ਦਾ ਬੱਚ ਜਾਂ ਸਟਾਰ ਕੋਲ ਇੰਨੀ ਪ੍ਰੋਪਰਟੀ ਆ ਸਟਾਰ ਦਾ ਇਹ ਘਰ ਆ ਇਹ ਬੇਫਜ਼ੂਲ ਦੀਆਂ ਖਬਰਾਂ ਛਾਪਣਗੇ ਲੇਕਿਨ ਕਦੇ ਇਹ ਨਹੀਂ ਦਿਖਾਉਣਗੇ ਵੀ ਕਿਸਾਨ ਕਿਸ ਚੀਜ਼ ਦੀ ਮਾਤ ਪੈ ਰਹੀ ਆ ਕਿਸਾਨ ਨੂੰ ਜਾਂ ਕਿਹੜੇ ਏਰੀਏ 'ਚ ਕਿੰਨਾ ਕਿੰਨਾ ਕੁ ਪਾਣੀ ਦਾ ਸਤਰ ਰਹਿ ਗਿਆ ਅਤੇ ਉਹਨੂੰ ਬਚਾਉਣ ਦੇ ਨਵੇਂ ਨਵੇਂ ਤਰੀਕੇ ਕੀ ਹੈ ਇਹ ਇੱਦਾਂ ਦਾ ਕੁਛ ਨਹੀਂ ਕਰਦੇ